ਮੈਂ ਨੈਨਸੀ ਮੈਂ ਇੱਕ ਵਾਰ ਸਿਲਵਰ ਰੌਕ ਹੋਟਲ ਦੇ ਮੈਨੇਜਮੈਂਟ ਨੂੰ ਇੱਕ ਖਾਣੇ ਦਾ ਔਡਰ ਕਰਿਆ ਸੀ ਕਿਉਂਕਿ ਮੇਰੀ ਭੈਣ ਦੇ ਘਰ ਅਚਾਨਕ ਹੀ ਮਹਿਮਾਨ ਆ ਗਏ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਇੱਥੇ ਨਜ਼ਦੀਕੀ ਕੋਈ ਵਧੀਆ ਜਿਹਾ ਰੈਸਟੋਰੈਂਟ ਹੈ ਕਿਉਂਕਿ ਮੈਨੂੰ ਕੁਝ ਖਾਣ ਵਾਲੀਆਂ ਵਸਤੂਆਂ ਦੀ ਲੋੜ ਪੈ ਗਈ ਹੈ ਘਰ ਅਚਾਨਕ ਹੀ ਕੁਝ ਮਹਿਮਾਨ ਆ ਗਏ ਹਨ ਮੈਂ ਐਨਾ ਸਾਰਾ ਖਾਣਾ ਤਿਆਰ ਕਰ ਨਹੀਂ ਕਰ ਸਕਦੀ ਤੁਸੀਂ ਮੇਰੇ ਲਈ ਕੁਝ ਖਾਣੇ ਦਾ ਔਡਰ ਕਰ ਦਿਉ ਤਾਂ ਮੈਂ ਆਪਣੀ ਭੈਣ ਦੇ ਰੈਸਟੋਰੈਂਟ ਹਾਊਸ ਦੀ ਐਡਰੈਸ ਨੂੰ ਹਾਊਸ ਨੰਬਰ ਫੋਟੀ ਫਾਈਵ ਰਾਮਵੋਕ ਕਲੋਨੀ ਨਵਾਂਸ਼ਹਿਰ ਲਈ ਖਾਣੇ ਦਾ ਔਡਰ ਕੀਤਾ ਸੀ ਜਿਸ ਵਿੱਚ ਮੈਂ ਕੜਾਹੀ ਪਨੀਰ ਦਾਲ ਮੱਖਣੀ ਕੜੀ ਰੋਟੀ ਅਤੇ ਚਾਵਲ ਔਡਰ ਕਰੇ ਸੀ ਇਹ ਔਡਰ ਮੇਰੀ ਭੈਣ ਦੇ ਘਰ ਸਹੀ ਟਾਈਮ ਨਾਲ ਪਹੁੰਚ ਗਿਆ ਅਤੇ ਅਤੇ ਮੇਰੀ ਭੈਣ ਨੇ ਖਾਣੇ ਦੀ ਬਹੁਤ ਤਾਰੀਫ ਕੀਤੀ